ਅਸੀਂ ਆਪਣੀ ਵੋਕਲ ਥਕਾਵਟ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀ ਤਕਨੀਕਾਂ ਦੀ ਵਰਤੋ ਕਰਦੇ ਹਾਂ ਜਿਵੇਂ ਕੀ ਅਸੀਂ ਆਪਣੀ ਵੋਕਲ ਥਕਾਵਟ ਨੂੰ ਦੂਰ ਕਰਨ ਲਈ ਦੂਸਰਿਆਂ ਨਾਲ ਗੱਲਬਾਤ ਘੱਟ ਕਰਨ ਦੇ ਹਾਂ ਅਤੇ ਜ਼ਿਆਦਾ ਦੇਰ ਚੁੱਪ ਰਹਿਣਾ ਚਾਹੁੰਦੇ ਹਾਂ ਤਾਂ ਕਿ ਸਾਡੀ ਵੋਕਲ ਨੂੰ ਆਰਾਮ ਮਿਲ ਸਕੇ ਅਤੇ ਇਸ ਦੇ ਨਾਲ ਹੀ ਅਸੀਂ ਆਪਣੀ ਵੋਕਲ ਥਕਾਵਟ ਨੂੰ ਦੂਰ ਕਰਨ ਲਈ ਗਰਮ ਪਾਣੀ ਵੀ ਗਰਾਰੇ ਕਰਦੇ ਹਾਂ ਤਾਂ ਕਿ ਜੋ ਵੀ ਸਾਡੇ ਗਲੇ ਵਿੱਚ ਇਨਫੈਕਸ਼ਨ ਹੁੰਦੀ ਹੈ ਉਹ ਦੂਰ ਹੋ ਸਕੇ ਅਤੇ ਇਸ ਦੇ ਨਾਲ ਹੀ ਅਸੀਂ ਕਈ ਤਰ੍ਹਾਂ ਦੇ ਤੇਲ ਦੀ ਮਸਾਜ ਵੀ ਆਪਣੇ ਗਲੇ ਉੱਪਰ ਕਰਦੇ ਹਾਂ ਤਾਂ ਕਿ ਜੋ ਸਾਨੂੰ ਵੋਕਲ ਥਕਾਵਟ ਹੈ ਉਸ ਵਿੱਚ ਆਰਾਮ ਮਿਲ ਸਕੇ ਜਿਸ ਨਾਲ ਸਾਡਾ ਵੋਕਲ ਪੂਰੀ ਤਰਾਂ ਤੰਦਰੁਸਤ ਹੋ ਸਕੇ ਅਸੀਂ ਆਪਣੀ ਆਵਾਜ਼ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੀ ਤਕਨੀਕਾਂ ਦੀ ਵਰਤੋਂ ਕਰਦੇ ਹਾਂ ਜਿਸ ਦੌਰਾਨ ਸਾਡੀ ਅਵਾਜ ਸੁਰੱਖਿਅਤ ਰਹਿ ਸਕੇ ਅਸੀਂ ਬਾਹਰ ਦੀ ਚੀਜ਼ਾਂ ਖਾਣ ਤੋਂ ਪਰਹੇਜ਼ ਕਰਦੇ ਹਾਂ ਕਿਉਂਕਿ ਉਸ ਵਿੱਚ ਕਈ ਤਰ੍ਹਾਂ ਦੀ ਮਿਰਚ ਮਸਾਲੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਖਾ ਕੇ ਸਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਿਸ ਨਾਲ ਸਾਡੀ ਆਵਾਜ਼ 'ਤੇ ਅਸਰ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਅਸੀਂ ਠੰਡੀ ਚੀਜ਼ਾਂ ਖਾਣ ਦਾ ਵੀ ਪਰਹੇਜ਼ ਕਰਦੇ ਹਾਂ ਕਿਉਂਕਿ ਠੰਡੀਆਂ ਚੀਜ਼ਾਂ ਖਾਣ ਨਾਲ ਸਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਸਾਡੀ ਆਵਾਜ਼ ਵਿੱਚ ਥਕਾਵਟ ਆ ਜਾਂਦੀ ਹੈ ਅਤੇ ਸਾਡਾ ਗਲਾ ਵੀ ਖਰਾਬ ਹੋ ਜਾਂਦਾ ਹੈ ਅਸੀਂ ਆਪਣੀ ਆਵਾਜ਼ ਦੀ ਸੁਰੱਖਿਆ ਲਈ ਆਚਾਰ ਆਦਿ ਤੋਂ ਵੀ ਪਰਹੇਜ਼ ਕਰਦੇ ਹਾਂ ਕਿਉਂਕਿ ਤਿੱਖੀਆਂ ਚੀਜ਼ਾਂ ਖਾਣ ਨਾਲ ਸਾਡੇ ਗਲੇ ਵਿੱਚ ਕਈ ਤਰ੍ਹਾਂ ਦੀ ਇਨਫੈਕਸ਼ਨ ਜਾਂ ਕੀੜੇ ਪੈਦਾ ਹੋ ਜਾਂਦੇ ਹਨ ਜੋ ਸਾਡੀ ਆਵਾਜ਼ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੇ ਹਨ ਅਤੇ ਸਾਡੀ ਆਵਾਜ਼ ਬਿਠਾ ਦਿੰਦੇ ਹਨ ਤਾਂ ਕਿ ਜਿਸ ਨਾਲ ਸਾਨੂੰ ਬੋਲਣ ਵਿੱਚ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਣੀ ਆਵਾਜ਼ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਗਰਮ ਪਾਣੀ ਦੇ ਗਰਾਰੇ ਵੀ ਕਰਦੇ ਹਾਂ ਤਾਂ ਕਿ ਸਾਡੀ ਆਵਾਜ਼ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਗਰਮ ਪਾਣੀ ਦੇ ਗਰਾਰੇ ਕਰਨ ਨਾ ਜੋ ਵੀ ਸਾਡੀ ਆਵਾਜ਼ ਵਿੱਚ ਜਾਂ ਸਾਡੇ ਗਲੇ ਦੀ ਇਨਫੈਕਸ਼ਨ ਹੁੰਦੀ ਹੈ ਉਹ ਦੂਰ ਹੋ ਸਕੇ ਤਾਂ ਕਿ ਸਾਡੀ ਆਵਾਜ਼ ਪੂਰੀ ਤਰ੍ਹਾਂ ਨਿਕਲ ਸਕੇ ਅਤੇ ਉੱਚੀ ਨਿਕਲ ਸਕੇ ਆ ਸਾਡੀ ਆਵਾਜ਼ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਕਈ ਤਰ੍ਹਾਂ ਦੇ ਖਾਣ ਪਾਣ ਦਾ ਵੀ ਪਰਹੇਜ਼ ਕਰਦੇ ਹਾਂ ਤਾਂ ਕਿ ਜੋ ਸਾਡੀ ਆਵਾਜ਼ ਨੂੰ ਖਰਾਬ ਨਾ ਕਰਨ